ਮੈਂ ਹੋਰ ਤਰੀਕੇ ਦੀ ਰਨਿੰਗ ਨਹੀਂ ਕੀਤੀ ਪਰ ਮੈਨੂੰ ਸਪਰਿੰਟ ਰਨਿੰਗ ਬਾਰੇ ਪਤਾ ਹੈ ਦੌੜਨ ਦੇ ਕਈ ਸਾਰੇ ਫ਼ਾਇਦੇ ਹਨ ਜਿਵੇਂ ਦੌੜਨ ਨਾਲ ਸਾਡੀ ਇਹ ਹੱਡੀਆਂ ਮਜ਼ਬੂਤ ਰਹਿੰਦੀਆਂ ਹਨ ਲੱਤਾਂ ਮਜ਼ਬੂਤ ਰਹਿੰਦੀਆਂ ਹਨ ਗੋਡੇ ਦੁਖਦੇ ਨਹੀਂ ਚਲਣ 'ਚ ਆਸਾਨੀ ਹੁੰਦੀ ਹੈ ਦੌੜ ਨਾਲ ਸਾਡਾ ਸਰੀਰ ਵਧੀਆ ਰਹਿੰਦਾ ਹੈ ਸਵੇਰ ਦੀ ਸੈਰ ਬਹੁਤ ਵਧੀਆ ਹੈ ਸਾਡੀਆਂ ਅੱਖਾਂ ਵਧੀਆ ਰਹਿੰਦੀਆਂ ਹਨ ਹਰਿਆਲੀ ਦੇਖਦੀਆਂ ਹਨ ਸਵੇਰ ਦੀ ਸੈਰ ਜ਼ਰੂਰ ਕਰਨੀ ਚਾਹੀਦੀ ਹੈ ਸਾ ਦੌੜਦੇ ਸਮੇਂ ਸਾਹ ਨਹੀਂ ਚੜਦਾ ਕਈਆਂ ਨੂੰ ਸਾਹ ਦੀ ਸਮੱਸਿਆ ਹੁੰਦੀ ਹੈ ਦੌੜਨ ਨਾਲ ਸ ਦੌੜਨ ਵਧੀਆ ਰਹਿੰਦੇ ਹਨ ਸੈਰ ਕਰਨ ਨਾਲ ਉਹਨਾਂ ਦਾ ਸਰੀਰ ਵਧੀਆ ਰਹਿੰਦਾ ਹੈ ਉਹ ਤੰਦਰੁਸਤ ਰਹਿੰਦੇ ਹਨ ਬਜ਼ੁਰਗ ਸੈਰ ਨਹੀਂ ਕਰਦੇ ਤਾਂ ਉਹਨਾਂ ਦਾ ਸਰੀਰ ਤੰਦਰੁਸਤ ਨਹੀਂ ਰਹਿੰਦਾ ਉਹਨਾਂ ਨੂੰ ਡਾਕਟਰਾਂ ਕੋਲ ਵਾਰ ਵਾਰ ਜਾਣਾ ਪੈਂਦਾ ਹੈ ਉਹਨਾਂ ਨੂੰ ਕਈ ਸਾਰੀਆਂ ਪ੍ਰੋਬਲਮਾਂ ਦਾ ਸਾਹਮਣਾ ਕਰਨਾ ਪੈਂਦਾ ਹੈ ਇਸ ਕਰਕੇ ਦੌੜਨਾ ਚਾਹੀਦਾ ਹੈ ਸਵੇਰ ਦੀ ਸੈਰ ਕਰਨੀ ਚਾਹੀਦੀ ਹੈ ਉਹਦੇ ਨਾਲ ਸਰੀਰ ਤੰਦਰੁਸਤ ਰਹਿੰਦਾ ਹੈ ਵਧੀਆ ਰਹਿੰਦਾ ਹੈ ਅਤੇ ਸਰੀਰ ਕਮਜ਼ੋਰ ਨਹੀਂ ਹੁੰਦਾ ਯਾਦਸ਼ਕਤੀ ਵਧੀਆ ਰਹਿੰਦੀ ਹੈ ਸਵੇਰ ਦੀ ਸੈਰ ਕਰਦੇ ਰਹਿਣਾ ਚਾਹੀਦਾ ਹੈ ਕਈ ਸ਼ਾਮ ਵੇਲੇ ਵੀ ਕਰਦੇ ਹਨ ਦੁਪਹਿਰ ਵੇਲੇ ਵੀ ਕਰਦੇ ਹਨ ਸਵੇਰ ਦੀ ਸੈਰ ਕਰਦੇ ਰਹਿਣਾ ਚਾਹੀਦਾ ਹੈ